ਸੱਤ ਲੱਖ ਅੱਠ ਹਜ਼ਾਰ ਦੋ ਸੌ ਛਿਆਸੀ ਦੋ ਲੱਖ ਤੀਹ ਹਜ਼ਾਰ ਚਾਰ ਸੌ ਬਿਆਲੀ ਅੱ ਤਿੰਨ ਲੱਖ ਪੰਤਾਲੀ ਹਜ਼ਾਰ ਦੋ ਸੌ ਅਠਾਸੀ ਪੰਜ ਲੱਖ ਅਠਾਰਾਂ ਹਜ਼ਾਰ ਸੱਤ ਸੌ ਨੜਿੱਨਵੇ ਚਾਰ ਲੱਖ ਪੱਚੀ ਹਜ਼ਾਰ ਛੇ ਸੌ ਪੈਂਹਟ